ਹਾਂਜੀ ਮੈਂ ਯੋਕਾ ਯੋਗਾ ਕਰਕੇ ਬਹੁਤ ਹੀ ਵਧੀਆ ਬਿਹਤਰ ਮਾਨਸਿਕ ਸਰੀਰਿਕ ਸਿਹਤ ਦਾ ਅਨੁਵਤ ਕੀ ਅਨੁਭਵ ਕੀਤਾ ਹੈ ਮੈਨੂੰ ਜੋਗ ਕਰਕੇ ਬਹੁਤ ਹੀ ਚੰਗਾ ਲੱਗਦਾ ਹੈ ਮੇਰੇ ਸ਼ਰੀਰ ਵਿੱਚ ਤੰਦਰੁਸਤੀ ਫੁਰਤੀ ਚਤੁਰਤੀ ਆਦਿ ਬਹੁਤ ਜ਼ਿਆਦਾ ਆਉਂਦੀ ਹੈ ਅਤੇ ਮੇਰਾ ਬਲੱਡ ਪ੍ਰੈਸ਼ਰ ਵੀ ਚੰਗੀ ਤਰ੍ਹਾਂ ਨਾਲ ਚੱਲਦਾ ਹੈ ਖੂਨ ਵੀ ਬਣਿਆ ਰਹਿੰਦਾ ਹੈ ਅਤੇ ਮੇਰੀਆਂ ਨਸਾਂ ਵਗੈਰਾ ਵੀ ਦਰਦ ਨਹੀਂ ਕਰਦੀਆਂ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਅਤੇ ਸਰੀਰ ਵਿੱਚ ਕੋਈ ਵੀ ਤਕਲੀਫ਼ ਨਹੀਂ ਹੁੰਦੀ ਫਿਟ ਰਹਿੰਦੀ ਹਾਂ ਕੋਈ ਵੀ ਤੰਗੀ ਨਹੀਂ ਆਉਂਦੀ ਕਿਸੇ ਪ੍ਰਕਾਰ ਦੀ ਵੀ ਕੈਮੀਕਲ ਰਸਾਇਨਿਕ ਦਵਾਈਆਂ ਮੈਨੂੰ ਲੈਣ ਦੀ ਲੋੜ ਨਹੀਂ ਪੈਂਦੀ ਜਦ ਤੋਂ ਮੈਂ ਯੋਗ ਕਰਨਾ ਸਟਾਰਟ ਕੀਤਾ ਹੈ ਯੋਗ ਇੱਕ ਐਸੀ ਦਵਾਈ ਹੈ ਜੋ ਬੰਦਾ ਵੀ ਕਰੇਗਾ ਕਦੀ ਵੀ ਬਿਮਾਰ ਨਹੀਂ ਪਵੇਗਾ ਯੋਗ ਯੋਗ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅੱਜ ਅੱਜ ਅੱਜ ਕੱਲ੍ਹ ਆਪਾਂ ਜੇ ਜਿਉਣਾ ਹੈ ਤਾਂ ਸਾਨੂੰ ਯੋਗ ਕਰਨਾ ਹੀ ਪੈਣਾ ਹੈ ਯੋਗ ਤੋਂ ਬਿਨ੍ਹਾਂ ਆਪਾਂ ਜੀਵਿਤ ਨਹੀਂ ਰਹਿ ਸਕਦੇ ਅੱਜ ਸਾਨੂੰ ਸਵੇਰੇ ਸਵੇਰੇ ਉੱਠ ਕੇ ਤੰਦਰੁਸਤ ਸ਼ੁੱਧ ਹਵਾ ਲੈਣੀ ਚਾਹੀਦੀ ਹੈ ਜੋ ਕਿ ਸਾਡੇ ਫੇਫੜਿਆਂ ਅਤੇ ਨਸਾਂ ਨੂੰ ਖੋਲ੍ਹਦੀ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਦੀ ਹੈ